ਮੈਂ ਮੈਂ ਬਚਪਨ ਦੇ ਵਿੱਚ ਹੀ ਬੁਣਾਈ ਅਤੇ ਸਿਲਾਈ ਸ਼ੁਰੂ ਕਰ ਦਿੱਤੀ ਕਿਉਂਕਿ ਮੇਰੀ ਦਿਲਚਸਪੀ ਆਪਣੀ ਮੇਰੀ ਮਾਤਾ ਜੀ ਬੁਣਾਈ ਅਤੇ ਸਿਲਾਈ ਦਾ ਕੰਮ ਕਰਦੇ ਸੀ ਇਥੋਂ ਹੀ ਮੈਨੂੰ ਦਿਲਚਸਪੀ ਪੈਦਾ ਹੋ ਗਈ ਅਤੇ ਮੈਨੂੰ ਇਸ ਨੂੰ ਕਰਦੇ ਰਹਿਣ ਦੀ ਪ੍ਰੇਰਨਾ ਮੇਰੀ ਇਹੋ ਹੀ ਸੀ ਕਿਉਂਕਿ ਜਦੋਂ ਮੇਰੀ ਮੈਰਿਜ ਹੋਈ ਵਿਆਹ ਵਿਆਹ ਹੋਇਆ ਤਾਂ ਮੈਨੂੰ ਆ ਏ ਮੇਰੇ ਪਰਿਵਾਰ ਨੂੰ ਪੈਸੇ ਦੀ ਲੋੜ ਸੀ ਤਾਂ ਇਸ ਕਰਕੇ ਮੈਂ ਇਹ ਆਪਣਾ ਕੰਮ ਅੱਗੇ ਵੀ ਜਾਰੀ ਰੱਖਿਆ ਅਤੇ ਮੈਂ ਆ ਕੇ ਬੁਣਾਈ ਅਤੇ ਸਿਲਾਈ ਆਪਣੇ ਸੋਹਰੇ ਪਰਿਵਾਰ ਦੇ ਵਿੱਚ ਵੀ ਬੁਣਾਈ ਅਤੇ ਸਿਲਾਈ ਦਾ ਕੰਮ ਕੀਤਾ ਅਤੇ ਇਹਦੇ ਨਾਲ ਮੇਰਾ ਆਮਦਨ ਦਾ ਸਾਧਨ ਬਣ ਗਿਆ ਅਤੇ ਮੇਰੇ ਪਤੀ ਨੂੰ ਹੀ ਇਸ ਦੀ ਹੈਲਪ ਮਦਦ ਮਿਲ ਗਈ ਅਤੇ ਸਾਡੇ ਕੋਲ ਅਸੀਂ ਆਪਣੇ ਬੱਚਿਆਂ ਨੂੰ ਰਲ ਕੇ ਦੋਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਪਾਲਿਆ ਅਤੇ ਉਹਨਾਂ ਨੂੰ ਚੰਗੀ ਪਰਵਰਿਸ਼ ਦਿੱਤੀ ਅਤੇ ਉਹਨਾਂ ਨੂੰ ਚੰਗਾ ਪੜ੍ਹਾਇਆ ਲਿਖਾਇਆ ਅਤੇ ਉਹਨਾਂ ਨੂੰ ਆਪਣਾ ਕਾਮਯਾਬ ਬਣਾਇਆ ਤਾਂ ਕਿ ਉਹ ਅੱਗੇ ਜਾ ਕੇ ਉਹਨਾਂ ਨੂੰ ਕੋਈ ਮੁਸ਼ਕਿਲ ਪੈਦਾ ਨਾ ਹੋਵੇ ਅਤੇ ਇਹਦੇ ਨਾਲ ਮੇਰੇ ਮਹੱਲੇ ਦੇ ਵਿੱਚ ਵੀ ਮੇਰਾ ਨਾਮ ਵਧਿਆ ਉਹਨਾਂ ਜਿਹਨਾਂ ਲੋਕਾਂ ਨੂੰ ਮੇਰੇ ਬਾਰੇ ਪਤਾ ਵੀ ਨਹੀਂ ਸੀ ਉਹ ਮੇਰੇ ਕੋਲ ਸਿਲਾਈ ਕਰਾਉਣ ਵਾਸਤੇ ਆਉਂਦੇ ਸੀ ਮੇਰੇ ਕੋਲ ਕੱਪੜੇ ਸਵਾਉਣ ਵਗੈਰਾ ਆਉਂਦੇ ਸੀਗੇ ਅਤੇ ਉਹਨਾਂ ਨੇ ਉਹਨਾਂ ਨੇ ਮੇਰੇ ਕੱਪੜੇ ਵੀ ਪਸੰਦ ਕੀਤੇ ਮੇਰੀਆਂ ਤਰੀਫਾਂ ਵੀ ਕੀਤੀਆਂ ਅਤੇ ਮੈਨੂੰ ਇਹ ਬਹੁਤ ਵਧੀਆ ਸੁਣ ਕੇ ਲੱਗਾ ਹਨ ਅਤੇ ਇਸ ਕਰਕੇ ਮੈਂ ਆਪਣਾ ਕੰਮ ਜਿਹੜਾ ਹਾਲੇ ਤੱਕ ਸ਼ੁਰੂ ਕੀਤਾ ਹੋਇਆ ਅਤੇ ਕਰਦੀ ਰਹਾਂਗੀ